ਬਹੁਤ ਪੰਜਾਬ ਦੇ ਵਿੱਚ ਕਹਿ ਦੇਈਏ ਬੁੱਕਸ ਦੇ ਵਿੱਚ ਬਹੁਤ ਸਾਰਿਆਂ ਸ਼ੈਲੀਆਂ ਪਾਈਆਂ ਜਾਂਦੀਆਂ ਨੇ ਪਰ ਮੈਨੂੰ ਜ਼ਿਆਦਾਤਰ ਕਵਿਤਾਵਾਂ ਨਾਲੋਂ ਜ਼ਿਆਦਾ ਵੱਧ ਵਾਰਤਕ ਲੱਗਦਾ ਅਤੇ ਵਾਰਤਕ ਵਿੱਚ ਸਭ ਤੋਂ ਵੱਧ ਨਾਵਲ ਮੈਨੂੰ ਪਸੰਦ ਨੇ ਪੜ੍ਹਨੇ ਜੇ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਅੱਗੇ ਇਕ ਉਹ ਪੜ੍ਹਨਾ ਚਾਹਵਾਂ ਤਾਂ ਉਹ ਨਾਵਲ ਹੀ ਹੋਣਗੇ ਕਿਉਂਕਿ ਨਾਵਲ ਸਿੱਧਾ ਸਪੱਸ਼ਟ ਸਿਰਜਿਆ ਜਾਂਦਾ ਅਤੇ ਨਾਵਲ ਤੋਂ ਸਾਨੂੰ ਸਮਾਜ ਦੀ ਸੋਚ ਸਮਾਜ ਬਾਰੇ ਪਤਾ ਲੱਗਦਾ ਹੈ ਇੱਕ ਸਿੱਖਿਅਕ ਵੀ ਹੈ ਰਿਐਲਿਟੀ ਵੀ ਹੈ ਅਤੇ ਤੁਸੀਂ ਉਸਦੇ ਅੰਦਰ ਹੋ ਜਾਂਦੇ ਓ ਉਸ ਜਗ੍ਹਾ ਨੂੰ ਮਹਿਸੂਸ ਕਰ ਸਕਦੇ ਹੋ ਰੀਸੈਂਟਲੀ ਮੈਂ ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਨਾਵਲ ਪੜ੍ਹਿਆ ਜਿਸ ਵਿੱਚ ਇੱਕ ਲੇਡੀ ਦੀ ਮੈਂਟਲੀ ਡੈਥ ਕਿੱਦਾਂ ਹੋ ਜਾਂਦੀ ਹੈ ਅਤੇ ਉਹ ਕਿੱਦਾਂ ਇੱਕ ਜ਼ਿੰਦਾ ਲਾਸ਼ ਬਣ ਕੇ ਰਹਿੰਦੀ ਹੈ ਕਿੱਦਾਂ ਫਿਰ ਵੀ ਉਸ ਨੂੰ ਆਪਣੇ ਜੀਵਨ ਦੇ ਸਾਰੇ ਕਰਤੱਵ ਨਿਭਾਉਣੇ ਪੈਂਦੇ ਨੇ ਕਿਵੇਂ ਜਿਉਣਾ ਹੈ ਮਰ ਕੇ ਇੱਕ ਮਨ ਦੇ ਤੌਰ 'ਤੇ ਮਰ ਜਾਣਾ ਅਤੇ ਇੱਕ ਲਾਸ਼ ਦੇ ਵਾਂਗੂ ਜਿੰ ਜ਼ਿੰਦਾ ਰਹਿਣਾ ਇਹ ਸਾਡੇ 'ਚ ਜਿਹੜਾ ਹੈਗਾ ਪੰਜਾਬ ਦਾ ਸ਼ਡਿਊਲ ਹੀ ਆ ਅੱਜ ਕਾ ਤਾਂ ਦੁਨੀਆ ਬਹੁਤ ਮੋਡਰਨ ਹੋ ਗਈ ਹੈ ਕੁੜੀਆਂ ਨੂੰ ਬਹੁਤ ਅਜ਼ਾਦੀ ਮਿਲ ਗਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਵੀ ਇਹ ਪੰਜਾਬ ਦੀ ਜਾਂ ਹੋਰ ਸ਼ਹਿਰਾਂ ਦੀ ਕਹਿ ਲਈਏ ਇੰਡੀਆ ਦੀ ਸੱਚਾਈ ਹੈ